ਖੇਡਾਂ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭਾਗ ਹਨ ਸਾਨੂੰ ਖੇਡਾਂ ਬਚਪਨ ਤੋਂ ਹੀ ਖੇਡਣੀਆਂ ਚਾਹੀਦੀਆਂ ਹਨ ਕ੍ਰਿਕਟ ਮੈਚ ਮੇਰੀ ਫੇਵਰਿਟ ਸੌਂਗ ਹੈ ਮੈਂ ਹਰ ਰੋਜ਼ ਖੇਡਦੀ ਹਾਂ ਮੈਨੂੰ ਬਹੁਤ ਹੀ ਆਨੰਦ ਆਉਂਦਾ ਅਤੇ ਇਸ ਨਾਲ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਨੂੰ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਸਾਡੀ ਤਾਂ ਕਿ ਸਾਡਾ ਦੇਸ਼ ਜਿੱਤ ਸਕੇ ਜਿਹੜਾ ਵੀ ਦਿਸ ਦੇਸ਼ ਜਿੱਤ ਜਾਂਦਾ ਹੈ ਉਸ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਸਾਨੂੰ ਵੀ ਆਪਣਾ ਦੇਸ਼ ਜਿਤਾਉਣਾ ਚਾਹੀਦਾ ਹੈ ਭਾਰਤ ਸਾਨੂੰ ਵੱਧ ਤੋਂ ਵੱਧ ਖੇਡਣਾ ਚਾਹੀਦਾ ਹੈ ਅਤੇ ਇਸ ਲਈ ਖੇਡਾਂ ਦੀ ਮਦਦ ਨਾਲ ਅਸੀਂ ਬਹੁਤ ਕੁਝ ਸਿੱਖਦੇ ਹਾਂ ਅਤੇ ਅੱਗੇ ਵੱਧਦੇ ਹਾਂ ਸਾਨੂੰ ਹਰ ਰੋਜ਼ ਇਹ ਖੇਡਾਂ ਸਿੱਖਣੀਆਂ ਚਾਹੀਦੀਆਂ ਹਨ ਕ੍ਰਿਕਟ ਮੈਚ ਮੈਨੂੰ ਬਹੁਤ ਹੀ ਪਸੰਦ ਹੈ ਅਤੇ ਇਸ ਵਿੱਚ ਹਰ ਰੋਜ਼ ਮੈਂ ਭਾਗ ਲੈਂਦੀ ਹਾਂ ਅਤੇ ਹਰ ਰੋਜ਼ ਖੇਡਦੀ ਰਹਿੰਦੀ ਹਾਂ